ਹੈਲੋ ਗੁਡ ਈਵਨਿੰਗ ਸਰ ਗੁੱਡ ਈਵਨਿੰਗ ਸਰ ਹਾਂਜੀ ਸਰ ਹਾਂਜੀ ਸਰ ਕੋਰੀਅਰ ਸਰਵਿਸ ਤੋਂ ਬੋਲ ਰਹੇ ਜੀ ਹਾਂਜੀ ਸਰ ਸਰ ਦੇਖ ਲੈਂਦੇ ਜੀ ਇੱਕ ਵਾਰ

ਚੈੱਕ ਕਰ ਲੈਂਦਾ ਸਰ ਮੈਂ ਤੁਹਾਡੇ ਪਿੱਛੋਂ ਨਹੀਂ ਆਏ ਹਜੇ ਤੱਕ ਜੀ ਬਾਕੀ ਮੈਂ ਦੇਖ ਲੈਂਦਾ ਹਾਂਜੀ ਹਾਂਜੀ ਤੁਹਾਡੀ ਹਾਂਜੀ ਠੀਕ ਹੈ ਚੈੱਕ ਕਰ ਲੈਂਦੇ ਆ ਜੀ ਤੁਹਾਡੀ ਜੀ ਹਜੇ ਪਿੱਛੋਂ ਗੱਡੀ ਲੋਡ ਨਹੀਂ ਹੋਈ ਜੀ ਅਜੇ ਜਦੋਂ ਹੋ ਗਈ ਅਸੀਂ ਤੁਹਾਨੂੰ ਤੁਹਾਨੂੰ ਦੱਸ ਦਾਂਗੇ ਪੂਰਾ ਅਜੇ ਪਿਛੋਂ ਚੱਲ ਨਹੀਂ ਰਿਹਾ ਮਾਲ ਆਇਆ ਨਹੀਂ ਹੈ ਜੀ ਜੀ ਹਾਂਜੀ ਸਰ ਪਿੱਛੇ ਮੌਸਮ ਖਰਾਬ ਹੋਣ ਕਰਕੇ ਵੀ ਹੋ ਸਕਦਾ ਗੱਡੀਆਂ ਚੱਲ ਨਹੀਂ ਰਹੀਆਂ ਹਾਂ ਹਾਂਜੀ ਹਾਂਜੀ ਸਰ

ਠੀਕ ਹੈ ਸਰ ਇੱਕ ਦੋ ਦਿਨਾਂ ਤੱਕ ਤੁਹਾਨੂੰ ਪਤਾ ਕਰਕੇ ਦੱਸ ਦਾਂਗੇ ਤੁਸੀਂ ਇੱਕ ਦੋ ਦਿਨ ਤੱਕ ਫਿਰ ਫੋਨ ਕਰ ਲਿਓ ਜੀ ਫਿਰ ਤੁਹਾਨੂੰ ਦਸ ਦਾਂਗੇ ਠੀਕ ਹੈ ਸਰ ਠੀਕ ਹੈ ਸਰ ਓਕੇ ਬਾਏ